ਹੋਰ ਕੀ ਹਾਲ ਹੈ ਵਧੀਆ ਵਧੀਆ ਘਰ ਸਭ ਠੀਕ

ਯਾਰ ਦੇਖ ਦੋ ਤਰੀਕੇ ਹੈਗੇ ਆ ਔਨਲਾਈਨ ਵੀ ਹੁੰਦਾ ਇੱਕ ਔਫ਼ਲਾਈਨ ਹੈਗਾ ਔਨਲਾਈਨ 'ਚ ਨਾ ਆਪਣਾ ਇੱਕ ਵੈੱਬਸਾਈਟ ਆਉਂਦੀ ਆ ਚੇਂਜ ਮਾਈ ਕਾਰ ਰਜਿਸਟ੍ਰੇਸ਼ਨ ਨੰਬਰ ਅਤੇ ਉਹਦੇ 'ਤੇ ਲੰਬਾ ਪ੍ਰੋਸੈੱਸ ਆ ਯਾਰ ਉਹਨੂੰ ਤੁਹਾਨੂੰ ਵੀਹ ਪੱਚੀ ਦਿਨ ਲੱਗ ਜਾਣੇ ਅਤੇ ਉਦੋਂ ਫਿਰ ਉਦੋਂ ਉਸ ਟਾਈਮ 'ਚ ਤੂੰ ਗੱਡੀ ਗੁੱਡੀ ਚਲਾਏਂਗਾ ਅੰਮ੍ਰਿਤਸਰ 'ਚ ਤੇਰਾ ਚਲਾਨ ਵਗੈਰਾ ਕਰ ਦੇਣਾ ਉਹਨਾਂ ਨੇ ਅਤੇ ਮੇਰੇ ਹਿਸਾਬ ਨਾਲ਼ ਹਾਂ ਮੇਰੇ ਹਿਸਾਬ ਨਾਲ਼ ਤੂੰ ਇੱਦਾਂ ਕਰੀ ਆਰ ਟੀ ਓ ਔਫਿਸ ਹੈਗਾ ਆਰ ਟੀ ਓ ਔਫਿਸ ਜਾਣਾ ਪੈਂਦਾ ਉੱਥੇ ਜਾ ਕੇ ਫੋਰਮ ਫਿਲ ਹੁੰਦਾ ਉਹਨਾਂ ਨੇ ਤੇਰਾ ਇੱਕ ਹਫ਼ਤੇ ਤੱਕ ਦਾ ਬਣਾ ਦੇਣਾ ਤੈਨੂੰ ਕਰ ਦੇਣਾ ਚੇਂਜ ਨੰਬਰ ਤੈਨੂੰ ਰਿਸਿਪਟ ਦੇ ਦੇਣਗੇ ਜੇ ਤੈਨੂੰ ਕਿੱਥੇ ਕਿਸੇ ਪੁਲਿਸ ਵਾਲੇ ਨੇ ਰੋਕਿਆ ਵੀ ਟ੍ਰੈਫ਼ਿਕ ਵਾਲੇ ਨੇ ਤਾਂ ਉਹ ਰਿਸਿਪਟ ਦਿਖਾ ਕੇ ਉੱਥੇ ਚਲਾਨ ਨਹੀਂ ਕੱਟੂੰਗੇ ਤੇਰਾ ਹਾਂ ਹਾਂ ਹਾਂ ਮੈਂ ਫ੍ਰੀ ਹਾਂ ਹਾਂ ਚੱਲ ਪੈਂਦੇ ਪਰਸੋਂ ਮੈਨੂੰ ਰਿੰਗ ਮਾਰ ਦਈਂ ਆ ਜਾਂਗਾ ਮੈਂ ਚਲਦੇ ਹਾਂ ਆਪਾਂ ਕਰਾ ਦਾਂਗੇ ਤੇਰਾ ਕੰਮ ਨਹੀਂ ਲਾਗੇ ਹੀ ਆ ਇੰਨਾਂ ਦੂਰ ਨਹੀਂ ਹੈਗਾ ਨੇੜੇ ਹੀ ਆ ਚੱਲ ਪਵਾਂਗੇ ਕੋਈ ਨਹੀਂ ਚੱਕਰ ਨਹੀਂ ਕੋਈ ਓ ਠੀਕ ਆ